ਯੋਗਾ ਅੱਜ ਕੱਲ੍ਹ ਬਹੁਤ ਮਸ਼ਹੂਰ ਹੈ ਅਤੇ ਬਹੁਤ ਸਾਰੇ ਲੋਗ ਇਸ ਤੋਂ ਬਹੁਤ ਸਾਰਾ ਲਾਭ ਉਠਾਉਂਦੇ ਹਨ ਮੇਰੇ ਖਿਆਲ ਵਿੱਚ ਲੋਗ ਯੋਗਾ ਇਸ ਲਈ ਸ਼ੁਰੂ ਕਰਦੇ ਹਨ ਕਿਉਂਕਿ ਉਹ ਆਪਣੀ ਸਿਹਤ ਨੂੰ ਸੁਧਾਰਨਾ ਚਾਹੁੰਦੇ ਹਨ ਜਾਂ ਉਸ ਤਨਾਅ ਭਰੀ ਜ਼ਿੰਦਗੀ ਤੋਂ ਰਾਹਤ ਪਾਉਣਾ ਚਾਹੁੰਦੇ ਹਨ ਜੇ ਮੈਂ ਯੋਗ ਸ਼ੁਰੂ ਕਰਨਾ ਹੁੰਦਾ ਤਾਂ ਮੈਂ ਸ਼ਾਇਦ ਇੱਕ ਯੋਗਾ ਕਲਾਸ ਵਿੱਚ ਸ਼ਾਮਿਲ ਹੁੰਦੀ ਜਾਂ ਮੈਂ ਯੂਟਿਊਬ ਤੋਂ ਦੇਖ ਕੇ ਵੀ ਸ਼ੁਰੂ ਕਰ ਸਕਦੀ ਸੀ ਮੈਂ ਹੌਲੀ ਹੌਲੀ ਸ਼ੁਰੂ ਕਰਾਂਗੀ ਅਤੇ ਹੌਲੀ ਹੌਲੀ ਆਪਣੀ ਤਾਕਤ ਅਤੇ ਲਚਕਤਾ ਨੂੰ ਵਧਾਉਂਗੀ ਮੈਨੂੰ ਲੱਗਦਾ ਕਿ ਯੋਗਾ ਮੇਰੇ ਰੋਜ਼ਾਨਾ ਜੀਵਨ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ ਇਹ ਮੈਨੂੰ ਤਨਾਓ ਤੋਂ ਰਾਹਤ ਦੇ ਸਕਦਾ ਮੇਰੀ ਨੀਂਦ ਨੂੰ ਸੁਧਾਰ ਸਕਦਾ ਹੈ ਅਤੇ ਮੇਰੀ ਊਰਜਾ ਨੂੰ ਵਧਾ ਸਕਦਾ ਹੈ ਇਹ ਮੈਨੂੰ ਆਪਣੇ ਸਰੀਰਿਕ ਨਾਲ ਵਧੇਰੇ ਜੁੜੇ ਹੋਣ ਵਿੱਚ ਮਦਦ ਕਰ ਸਕਦਾ ਮੈਨੂੰ ਲੱਗਦਾ ਹੈ ਕਿ ਯੋਗਾ ਹਰ ਉਮਰ ਦੇ ਲੋਕਾਂ ਲਈ ਇੱਕ ਵਧੀਆ ਕਸਰਤ ਹੈ ਇਹ ਇੱਕ ਘੱਟ ਪ੍ਰਭਾਵ ਵਾਲੀ ਕਸਰਤ ਹੈ ਇਸ ਲਈ ਜੋੜਾਂ ਲਈ ਬਹੁਤ ਚੰਗੀ ਹੈ ਇਹ ਮਾਨਸਿਕ ਸਿਹਤ ਲਈ ਵੀ ਬਹੁਤ ਵਧੀਆ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਯੋਗਾ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਜ਼ਰੂਰ ਅਜਮਾਉਣਾ ਚਾਹੀਦਾ ਤੁਸੀਂ ਹੈਰਾਨ ਹੋਵੋਗੇ ਕਿ ਇਹ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ